ਲੋਕ ਵਿਆਹ ਤੇ ਲਾੜੀ ਨੂੰ ਬਹੁਤ ਸਾਰੇ ਤੋਹਫੇ ਦਿੰਦੇ ਹਨ ਜੋ ਕਿ ਉਹ ਪਿਆਰ ਵਜੋਂ ਦਿੰਦੇ ਹਨ ਉਸਨੂੰ ਪਿਆਰ ਵਜੋਂ ਬਹੁਤ ਸਾਰੇ ਤੋਹਫੇ ਦਿੱਤੇ ਜਾਂਦੇ ਹਨ ਜਿਸ ਵਿੱਚ ਕੱਪੜੇ ਲੀੜੇ ਬਰਤਨ ਬਹੁਤ ਸਾ ਸਮਾਨ ਆਉਂਦਾ ਹੈ ਪਰ ਅੱਜ ਦੇ ਸਮੇਂ ਵਿੱਚ ਇਹ ਇੱਕ ਦਾਜ ਦਾ ਰੂਪ ਲੈ ਚੁੱਕੀ ਹੈ ਜਿਸ ਵਿੱਚ ਮੰਗ ਦੇ ਰੂਪ ਵਿੱਚ ਮੰਗਦੇ ਹਨ ਜਿਸ ਵਿੱਚ ਲੋਕੀ ਮੰਗ ਕਰਦੇ ਹਨ ਕਿ ਸਾਨੂੰ ਦਾਜ ਦੇ ਵਿੱਚ ਇਹ ਚਾਹੀਦਾ ਹੈ ਕਾਰ ਚਾਹੀਦੀ ਹੈ ਗੱਡੀ ਚਾਹੀਦੀ ਹੈ ਸਾਨੂੰ ਸੋਨਾ ਚਾਹੀਦਾ ਹੈ ਸਾਨੂੰ ਇਸ ਤਰ੍ਹਾਂ ਚਾਹੀਦਾ ਹੈ ਪਰ ਇਹ ਸੋਚਦੇ ਹਾਂ ਕਿ ਲਾੜੀ ਨੂੰ ਅਗਰ ਆਪਾਂ ਪਿਆਰ ਦੇ ਵਿੱਚ ਦਿੱਤਾ ਜਾਵੇ ਤਾਂ ਉਹ ਇੱਕ ਪਿਆਰ ਆਸ਼ੀਰਵਾਦ ਹੁੰਦਾ ਹੈ ਪਰ ਜਦੋਂ ਇਹ ਦਾਜ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਇਸਨੂੰ ਦਾਜ ਦੀ ਪ੍ਰਥਾ ਕਿਹਾ ਜਾਂਦਾ ਹੈ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਪ੍ਰਚਲਿਤ ਹੈ ਜੋ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਸਾਡੇ ਸਮਾਜ ਵਾਸਤੇ ਬਹੁਤ ਹੀ ਭਿਆਨਕ ਰੂਪ ਧਾਰਨ ਕਰਨ ਵਾਲੀ ਹੈ ਇਸ ਲਈ ਅਸੀਂ ਇਸ ਦਾਜ ਦੀ ਪ੍ਰਥਾ ਨੂੰ ਰੋਕਣਾ ਚਾਹੁੰਦੇ ਹਾਂ ਬਹੁਤ ਸਾਰੇ ਯਤਨ ਕਰਕੇ